ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਠੀਕ ਠਾਕ ਭਾਜੀ ਦੇਖੋ ਆਪਣੇ ਇੱਥੇ ਏਰੀਏ 'ਚ ਵੈਸੇ ਪੰਜ ਕੈਡਮੀਆਂ ਹੈ ਸੁਰਜੀਤ ਸਿੰਘ ਕੈਡਮੀ ਹੈ ਰਣਜੀਤ ਸਿੰਘ ਹੈ ਰਾਮਾ ਸਿੰਘ ਕੈਡਮੀ ਆ ਅਤੇ ਫਿਟਨਸ ਕੈਡਮੀ ਆ ਅਤੇ ਲੇਹਲ ਕੈਡਮੀ ਆ ਅਤੇ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕੀ ਜਿਹੜੀ ਲੇਹਲ ਸਪੋਰਟਸ ਕੈਡਮੀ ਆ ਸਾਡੇ ਸ਼ਹਿਰ ਨੇੜੇ ਕੁਰਾਲੀ 'ਚ ਓਹ ਸਭ ਤੋਂ ਬੈਸਟ ਆ ਜੀ ਉੱਥੇ ਸਾਰਾ ਮਤਲਬ ਉਹਨਾਂ ਦਾ ਜੋ ਵੀ ਸਾਰਾ ਸਮਾਨ ਏ ਕੈਡਮੀ ਦਾ ਉਹ ਵੀ ਨਵਾਂ ਏ ਵਧੀਆ ਏ ਫਰੈਸ਼ ਹੈ ਅਤੇ ਉਹਨਾਂ ਦੀ ਅਕੈਡਮੀ 'ਚ ਕੋਈ ਵੀ ਜੇਕਰ ਤੁਸੀਂ ਵੇਟ ਲੂਸ ਕਰਨਾ ਤਾਂ ਉਹਨਾਂ ਕੋਲ ਤਰੀਕੇ ਵੀ ਬਹੁਤ ਵਧੀਆ ਵਧੀਆ ਨਵੇਂ ਹੈ ਹਾਂਜੀ ਹਾਂਜੀ ਸਾ ਸਾਰਾ ਤੁਹਾਨੂੰ ਡਾਇਟ ਚੈਟ ਉਹ ਦੱਸਣਗੇ ਉੱਥੇ ਮੈਨਿਊ ਹੁੰਦਾ ਜੀ ਸਾਰਾ ਏ ਟੂ ਜੈਡ ਵੇਟ ਲੂਸ ਕਰਨਾ ਉੱਥੇ ਐਕਸਪਰਟ ਬੰਦੇ ਮਿਲਣਗੇ ਤੁਹਾਨੂੰ ਸਾਰਾ ਏ ਟੂ ਜੈਡ ਵਧੀਆ ਸਿਸਟਮ ਮਿਲੂਗਾ ਜੀ ਤੁਹਾਨੂੰ ਲੇਹਰ ਸਪੋਰਟਸ ਅਕੈਡਮੀ 'ਚ ਬਾਕੀਆਂ ਨਾਲੋਂ ਹਾਂਜੀ ਉੱਥੇ ਸੱਤ ਟ੍ਰੇਨਰ ਹੈ ਜੀ ਮੇਰੇ ਤੋਂ ਬਿਨਾਂ ਵੀ ਅਤੇ ਜਿਹੜੇ ਸੱਤ ਹਾਂਜੀ ਦੇਖੋ ਜਿਵੇਂ ਤੁਹਾਨੂੰ ਟ੍ਰੇਨਿੰਗ ਮੇਰੇ ਨਾਲ ਕਰਨੀ ਚਾਹੁੰਦੇ ਹੋ ਤਾਂ ਥੋੜ੍ਹਾ ਤੁਹਾਨੂੰ ਟੈਮ ਦਾ ਐਡਜਸਟ ਕਰਨਾ ਪੈਣਾ ਕਿਉਂਕਿ ਮੈਂ ਬਹੁਤ ਸਾਜਰੇ ਸਵੇਰੇ ਕਰਦਾ ਤਿੰਨ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਅਤੇ ਹਰ ਕੋਈ ਇਸ ਟਾਈਮ ਨਾਲ ਮੇਰੇ ਨਾਲ ਸਹਿਮਤ ਬਹੁਤ ਘੱਟ ਲੋਕ ਹੁੰਦੇ ਆ ਅਤੇ ਜੇਕਰ ਤੁਹਾਨੂੰ ਇਹ ਟਾਈਮਿੰਗ ਵਧੀਆ ਰਹੇਗੀ ਤਾਂ ਤੁਸੀਂ ਕਰ ਸਕਦੇ ਠੀਕ ਹੈ ਜੀ ਫ਼ਿਰ ਓਕੇ ਜੀ